ਪੰਜਾਬ ਵਿੱਚ ਬਹੁਤ ਸਾਰੇ ਮਸ਼ਹੂਰ ਪਕਵਾਨ ਮਿਲਦੇ ਹਨ ਉਹ ਜਿਨ੍ਹਾਂ ਵਿੱਚੋਂ ਇੱਕ ਸਭ ਤੋਂ ਇੱਕ ਹੈ ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ ਦੇ ਨਾਲ ਲੱਸੀ ਅਤੇ ਮੱਖਣ ਇਹ ਸਭ ਤੋਂ ਜ਼ਿਆਦਾ ਮਸ਼ਹੂਰ ਹੈ ਜੇ ਹੋਰ ਗੱਲ ਕਰੀਏ ਤਾਂ ਦਾਲ ਮੱਖਣੀ ਮ ਮਟਰ ਪਨੀਰ ਸ਼ਾਹੀ ਪਨੀਰ ਆਦਿ ਸਾਰਾ ਕੁਛ ਮਿਲ ਜਾਂਦਾ ਹੈ ਅਤੇ ਜੇ ਅੱਜ ਕੱਲ੍ਹ ਗੱਲ ਕਰੀਏ ਤਾਂ ਚਾਈਨਿਸ ਫੂਡ ਦੀ ਉਹਨੇ ਵੀ ਮਤਲਬ ਪੰਜਾਬ 'ਤੇ ਬਹੁਤ ਸਾਰਾ ਪ੍ਰਭਾਵ ਕੀਤਾ ਹੈ ਗੱਲ ਕਰੀਏ ਮਸ਼ਹੂਰ ਢਾਬਿਆਂ ਦੀ ਕ ਅਮਨ ਢਾਬਾ ਰਵਨੀਤ ਢਾਬਾ ਸੁਖਚੈਨ ਢਾਬਾ ਆਹ ਸਾਰੇ ਸਾਰੇ ਇੱਧਰ ਮਸ਼ਹੂਰ ਨੇ ਇਨ੍ਹਾਂ ਵਿੱਚ ਸਭ ਕੁਛ ਮਿਲ ਜਾਂਦਾ ਅਤੇ ਮੇਨ ਸਭ ਤੋਂ ਜ਼ਿਆਦਾ ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਉਪਲੱਬਧ ਹੈ